ਪੰਜਾਬੀ ਤੋਂ ਦੂਜੀਆਂ ਭਾਸ਼ਾਵਾਂ ਵਿੱਚ ਸਾਹਿਤ ਦਾ ਅਨੁਵਾਦ ਕਰਨਾ ਬਹੁਤ ਹੀ ਔਖਾ ਹੈ ਕਿਉਂਕਿ ਇਸ ਲਈ ਬਹੁਤ ਹੀ ਜ਼ਿਆਦਾ ਵਧੀਆ ਆਪਾਂ ਨੂੰ ਭਾਸ਼ਾਵਾਂ ਦੀ ਨੌਲੇਜ ਚਾਹੀਦੀ ਹੁੰਦੀ ਹੈ ਪਰ ਜਿਸ ਤਰ੍ਹਾਂ ਮੈਂ ਸੋਚਦਾ ਹਾਂ ਕਿ ਟੈਕਨੋਲਜੀ ਦਾ ਜ਼ਮਾਨਾ ਹੈ ਤਾਂ ਇਸ ਲਈ ਬਹੁਤ ਹੀ ਸਾਰੇ ਸੋਫਟਵੇਅਰ ਵਗੈਰਾ ਜਾਂ ਐਪਲੀਕੇਸ਼ਨਸ ਵਗੈਰਾ ਮਾਰਕੀਟ ਵਿੱਚ ਹਨ ਜੋ ਕਿ ਆਪਾਂ ਨੂੰ ਬਿਨਾਂ ਕਿਸੇ ਟੈਂਸ਼ਨ ਦੇ ਕਿਸੇ ਵੀ ਭਾਸ਼ਾ ਤੋਂ ਦੂਸਰੀ ਭਾਸ਼ਾ ਵਿੱਚ ਸਾਹਿਤ ਨੂੰ ਅਨੁਵਾਦ ਕਰਨ ਵਿੱਚ ਬਹੁਤ ਹੀ ਸਹਾਇਕ ਹੁੰਦੀਆਂ ਹਨ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਗੂਗਲ ਟਰਾਂਸਲੇਟਰ ਜਿਹਨਾਂ ਵਿੱਚ ਅਸੀਂ ਕਿਸੇ ਵੀ ਭਾਸ਼ਾ ਵਿੱਚ ਸਾਹਿਤ ਨੂੰ ਲਿਖਦੇ ਹਾਂ ਤਾਂ ਅਸੀਂ ਮਨਚਾਹੀ ਭਾਸ਼ਾ ਵਿੱਚ ਉਸ ਨੂੰ ਉਸ ਦਾ ਅਨੁਵਾਦ ਕਰ ਸਕਦੇ ਹਾਂ ਇਸ ਨਾਲ ਬਹੁਤ ਸਾਰੇ ਲਾਭ ਹਨ ਤਾਂ ਕਿ ਜੋ ਹੋਰ ਹੋਰਨਾਂ ਜ਼ਿਲ੍ਹਿਆਂ ਦੇ ਜਾਂ ਹੋਰਨਾਂ ਸ਼ਹਿਰਾਂ ਦੇ ਵਸਨੀਕ ਹਨ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਆਪਣੇ ਸਥਾਨਕ ਭਾਸ਼ਾ ਵਿੱਚ ਜਾਣਕਾਰੀ ਮਿਲ ਸਕਦੀ ਹੈ ਤਾਂ ਜੋ ਉਹ ਪੰਜਾਬੀ ਸੱਭਿਆਚਾਰ ਵੱਲ ਹੋਰ ਆਕਰਸ਼ਕ ਅਤੇ ਪ੍ਰਭਾਵਿਤ ਹੋਣ